ਸਾਡੇ ਖੇਤਰ ਗੁਰਦਾਸਪੁਰ ਵਿੱਚ ਦੀ ਖੇਤੀ ਬਹੁਤ ਵਧੀਆ ਹੁੰਦੀ ਹੈ ਇਸ ਵਿੱਚ ਸਭ ਤੋਂ ਪ੍ਰਮੁੱਖ ਫ਼ਸਲਾਂ ਹਨ ਕਣਕ ਝੋਨਾ ਮੱਕੀ ਅਸੀਂ ਇੱਥੇ ਵੀ ਬਿਜਾਈ ਕਰਦੇ ਹਾਂ ਇਸ ਤੋਂ ਇਲਾਵਾ ਵੀ ਸਾਡੇ ਇੱਥੇ ਮੂੰਗੀ ਦੀ ਮਾਹਵਾਂ ਦੀ ਰਾਜਮਾਂ ਦੀ ਅਤੇ ਹਰੀਆਂ ਸਬਜ਼ੀਆਂ ਦੀ ਵੀ ਖੇਤੀ ਕੀਤੀ ਜਾਂਦੀ ਹੈ ਜਿਸ ਨਾਲ ਇਲਾਕੇ ਦੇ ਸਾਰੇ ਇੱਕ ਲੋਕਾਂ ਨੂੰ ਇੱਥੋਂ ਤਾਜ਼ੀਆਂ ਫ਼ਸਲਾਂ ਫਸਲਾਂ ਜਿਹੜੀਆਂ ਵਾ ਪਹੁੰਚਾਈਆਂ ਜਾਂਦੀਆਂ ਹਨ ਅਤੇ ਹਰੇਕ ਦਾ ਇੱਥੇ ਮਤਲਬ ਕਿ ਪੂਰਤੀ ਕੀਤੀ ਜਾਂਦੀ ਹੈ ਅਤੇ ਜੋ ਕਿ ਕਿਸੇ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ ਕਿਉਂਕਿ ਸਾਡੇ ਲੋਕ ਇਥੋਂ ਦਾ ਜ਼ਿਆਦਾਤਰ ਘਰੇਲੂ ਹੀ ਖਾ ਕੇ ਖੁਸ਼ ਹਨ ਜੋ ਕਿ ਅਸੀਂ ਖੁਦ ਉਗਾਉਂਦੇ ਹਾਂ ਅਤੇ ਦੂਸਰਿਆਂ ਨੂੰ ਵੀ ਅਸੀਂ ਵੰਡਦੇ ਹਾਂ ਅਤੇ ਖੁਦ ਵੀ ਖਾਂਦੇ ਹਾਂ ਇਸ ਨੂੰ ਵੇਖ ਕੇ ਸਾਡੇ ਇਲਾਕੇ ਦਾ ਨਾਂ ਬਹੁਤ ਪ੍ਰਫੁੱਲਿਤ ਹੈ